ਸਾਡੇ ਕਸਬੇ ਦੇ ਵਿੱਚ ਸਿਹਤ ਸੰਭਾਲ ਦੀਆਂ ਇੰਨੀਆਂ ਸਹੂਲਤਾਂ ਨਹੀਂ ਹਨ ਚਾਹੇ ਰਾਜ ਸਰਕਾਰ ਨੇ ਇੱਥੇ ਡਿਸਪੈਂਸਰੀਆਂ ਕਾਫ਼ੀ ਹੱਦ ਤੱਕ ਡਿਸਪੈਂਸਰੀਆਂ ਖੋਲ੍ਹੀਆਂ ਹਨ ਪਰ ਇੱਕ ਚੰਗੇ ਡਾਕਟਰ ਉਹ ਇੱਥੇ ਕਸਬਿਆਂ ਦੇ ਵਿੱਚ ਆਉਣਾ ਪਸੰਦ ਨਹੀਂ ਕਰਦੇ ਕਿਉਂਕਿ ਸ਼ਹਿਰ ਦੇ ਮੁਕਾਬਲੇ ਕਸਬਿਆਂ ਦੇ ਵਿੱਚ ਜੀਵਨ ਪੱਧਰ ਦੀਆਂ ਸਾਰੀਆਂ ਸਹੂਲਤਾਂ ਨਹੀਂ ਹਨ ਐ ਇਸ ਕਰਕੇ ਸਾਨੂੰ ਮੈਂ ਆਪਣੇ ਸਿਹਤ ਬਿਹਤਰ ਸਿਹਤ ਦੀਆਂ ਲਈ ਸਾਨੂੰ ਮੈਂ ਆਪਣੇ ਆਪ ਨੂੰ ਸਮਝਦੀ ਹਾਂ ਕਿ ਇੱਕ ਸ਼ਹਿਰ ਦੇ ਵਿੱਚ ਪ੍ਰਵਾਸ ਕਰਨਾ ਜ਼ਿਆਦਾ ਪਸੰਦ ਕਰਦੀ ਹਾਂ ਕਿਉਂਕਿ ਕੁਛ ਐਮਰਜੈਂਸੀਆਂ ਹੁੰਦੀਆਂ ਹਨ ਸਿਹਤ ਸੰਬੰਧੀ ਕੁਛ ਐਮਰਜੈਂਸੀ ਹੁੰਦੀ ਕਈ ਵਾਰ ਹੋ ਜਾਂਦੀ ਹੈ ਜਿਸ ਦਾ ਪੋਪਰ ਪ੍ਰੋਪਰ ਇਲਾਜ ਆਪਾਂ ਉੱਥੇ ਹੀ ਕਸਬੇ ਦੇ ਵਿੱਚ ਉੰਨੀ ਟੈਕਨੋਲੋਜੀ ਡਿਵੈਲਪ ਨਾ ਹੋਣ ਕਰਕੇ ਸਾਨੂੰ ਸ਼ਹਿਰ ਵੱਲ ਹੀ ਰੁੱਖ ਕਰਨਾ ਪੈਂਦਾ ਹੈ ਇਸ ਲਈ ਮੈਂ ਭਵਿੱਖ ਵਿੱਚ ਆਪਣੀ ਬਿਹਤਰ ਸਿਹਤ ਸਹੂਲਤਾਂ ਪ੍ਰਾਪਤ ਕਰਨ ਲਈ ਸ਼ਹਿਰ ਵੱਲ ਪ੍ਰਵਾਸ ਕਰਨਾ ਪਸੰਦ ਕਰਦੀ ਹਾਂ